ਪੰਜਾਬੀ ਸੱਭਿਆਚਾਰ ਵਿੱਚ ਭੰਗੜੇ ਦੀ ਬਹੁਤ ਮਹੱਤਤਾ ਹੈ ਲੋਕੀ ਜਦੋਂ ਕੋਈ ਘਰ ਵਿੱਚ ਤਿਉਹਾਰ ਜਾ ਕੋਈ ਖੁਸ਼ੀ ਦਾ ਮੌਕਾ ਹੁੰਦਾ ਹੈ ਉਦੋਂ ਲੋਕੀ ਭੰਗੜਾ ਪਾ ਕੇ ਆਪਦੀ ਖੁਜੀ ਖੁਸ਼ੀ ਦਾ ਇਜ਼ਹਾਰ ਕਰਦੇ ਹਨ